ਮੇਰੇ ਨੇੜਲੇ ਇਲਾਕਿਆਂ ਵਿੱਚ ਕੁਦਰਤੀ ਸੁੰਦਰਤਾ ਬਹੁਤ ਹੈ ਕਿਉਂਕਿ ਸਾਡੇ ਨੇੜਲੇ ਇਲਾਕਿਆਂ ਵਿੱਚ ਚੰਡੀਗੜ੍ਹ ਸ਼ਹਿਰ ਪੈਂਦਾ ਹੈ ਉੱਥੇ ਬਹੁ ਪਹਾੜੀਆਂ ਬਹੁਤ ਸੁੰਦਰ ਦ੍ਰਿਸ਼ ਹੈ ਅਸੀਂ ਉੱਥੇ ਪਹਾੜੀਆਂ ਵਿੱਚ ਘੁੰਮਣ ਵਾਸਤੇ ਜਾਂਦੇ ਰਹਿੰਦੇ ਹਾਂ ਪਹਾੜੀਆਂ ਦਾ ਦ੍ਰਿਸ਼ ਬਹੁਤ ਹੀ ਸੁੰਦਰ ਅਤੇ ਅਦਭੁਤ ਹੈ ਉੱਥੇ ਝੀਲਾਂ ਬਹੁਤ ਸਾਰੀਆਂ ਝੀਲਾਂ ਅਤੇ ਨਦੀਆਂ ਹਨ ਅਤੇ ਝਰਨੇ ਬਹੁਤ ਲੱਗੇ ਸੁੰਦਰ ਲੱਗੇ ਹੋਏ ਹਨ ਉੱਥੇ ਜੰਗਲ ਵਿੱਚ ਬਹੁਤ ਸਾਰੇ ਪੰਛੀ ਦੇਖਣ ਨੂੰ ਮਿਲਦੇ ਹਨ